ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਬੀ ਜੀ ਮੈਂ ਮੇਰਾ ਬਸ ਵਧੀਆ ਤੁਸੀਂ ਸੁਣਾਓ ਹੋਰ ਕੀ ਕਰੀ ਜਾਂਦੇ ਸੀ ਅੱਛਾ ਬਸ ਮੈਂ ਵੀ ਉਹ ਹੀ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਬਸ ਮੁੰਡੇ ਦਾ ਵਿਆਹ ਰੱਖਿਆ ਸੀ ਤੁਹਾਨੂੰ ਵੀ ਜੀ ਤੁਹਾਨੂੰ ਪਹਿਲਾਂ ਕੁੜੀ ਲੁਧਿਆਣੇ ਦੀ ਹੁੰ ਦੇਖੋ ਜੇ ਦਸ ਮਾਰਚ ਦਾ ਕੀਤਾ ਹੈ ਫਾਈਨਲ ਹਾਂਜੀ ਵਧੀਆ ਧੰ ਧੰਨਵਾਦ ਜੀ ਧੰਨਵਾਦ ਤੁਹਾਨੂੰ ਵੀ ਮੈਂ ਕਿਹਾ ਹੋਰ ਕਰ ਦੇਈਏ ਪਹਿਲਾਂ ਹੀ ਵੀ ਬੱਚੇ ਖੁਸ਼ ਰਹਿਣਗੇ ਆਪਣਾ ਅਤੇ ਅੱਛਾ ਭਾਬੀ ਜੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਵੀ ਜਿੱਦਾਂ ਹੁਣ ਤੁਹਾਨੂੰ ਦੱਸਿਆ ਵਿਆਹ ਹੈ ਅਤੇ ਉਹਦਾ ਨਾ ਅਸੀਂ ਮਤਲਬ ਘਰ ਸਾਰਾ ਦੁਬਾਰਾ ਬਣਾ ਰਹੇ ਸੀ ਅਤੇ ਥੋੜ੍ਹਾ ਜਿਹਾ ਆਂਢ ਗੁਆਂਢ 'ਚ ਵੀ ਤੁਹਾਨੂੰ ਪਤਾ ਹੀ ਆ ਫਿਰ ਹੁੰਦਾ ਥੋੜ੍ਹਾ ਬਹੁਤ ਅਤੇ ਕੰਮ ਕਰਵਾਉਣ ਵਾਸਤੇ ਨਾ ਜਿਵੇਂ ਸੀਮੇਂਟ ਵਗੈਰਾ ਹੋ ਗਿਆ ਅਤੇ ਉਹ ਬਾਹਰ ਰਹੇਗਾ ਅਤੇ ਸਾਰਾ ਕੰਮ ਕਰਵਾਉਣਾ ਤਾਂ ਫਿਰ ਥੋੜ੍ਹਾ ਬਹੁਤ ਮਿੱਟੀ ਧੂੜ ਘੱਟਾ ਹੋਵੇਗਾ ਥੋੜ੍ਹਾ ਜਿਹਾ ਮਤਲਬ ਸਾਡੇ ਨਾਲ ਨਾ ਕੋਆਪਰੇਟ ਕਰ ਲਿਓ ਵੀ ਇੱਦਾਂ ਕਰਦੇ ਹਾਂ ਨਾ ਮੈਂ ਕਿਹਾ ਵੀ ਪਹਿਲਾਂ ਦੱਸ ਦਾਂ ਕਿ ਪੈ ਫੇ ਰਿਸ਼ਤੇਦਾਰ ਵਗੈਰਾ ਵੀ ਆਉਣੇ ਆ ਅਤੇ ਫਿਰ ਕੁੜੀ ਨੇ ਵੀ ਆਉਣਾ ਅਤੇ ਨਵਾਂ ਕਮਰਾ ਬਣਾਉਣਾ ਅਸੀਂ ਅਤੇ ਇਸ ਕਾਰਨ

ਹਾਂਜੀ ਹਾਂਜੀ ਉਹ ਹੀ ਨਾ ਵੀ ਥੋੜ੍ਹਾ ਬਹੁਤ ਮਤਲਬ ਕਰ ਲਿਓ ਦੇਖ ਲਿਓ ਹਾਂਜੀ ਹੋਰ ਬਸ ਕਿੱਦਾਂ ਹਾਂਜੀ ਅਸੀਂ ਨਹੀਂ ਨਹੀਂ ਨਹੀਂ ਨਹੀਂ ਮੈਂ ਦੱਸਦੀ ਹਾਂ ਤੁਹਾਨੂੰ ਅਸੀਂ ਪਹਿਲਾਂ ਸੋਚਿਆ ਸੀ ਵੀ ਪਹਿਲਾਂ ਅਸੀਂ ਉੱਪਰ ਵਾਲਾ ਹੀ ਪੋਰਸ਼ਨ ਕਰਵਾਈਏ ਰੀਨੋਵੇਟ ਫਿਰ ਮੁੰਡਾ ਕਹਿੰਦਾ ਨਹੀਂ ਮੈਂ ਕਰਾਵਾ ਦੁੰਗਾ ਨਾਲ ਤੇ ਫਿਰ ਬਾਹਰੋਂ ਆਇਆ ਨੂੰ ਫਿਰ ਹੁੰਦਾ ਹੀ ਆ ਥੋੜ੍ਹਾ ਬਹੁਤ ਕਿ ਕਰਵਾ ਦੇਈਏ ਘਰ

ਉਹ ਹੀ ਨਾ ਫਿਰ ਬੱਚੇ ਖੁਸ਼ ਰਹਿਣ ਅਤੇ ਇਸ ਲਈ ਸਾਨੂੰ ਵੀ ਮੰਨਣਾ ਹੀ ਪੈਣਾ ਉਹਦੇ ਨਾਲ ਅਤੇ ਇਸ ਲਈ ਫਿਰ ਅਸੀਂ ਸਾਰਾ ਘਰ ਹੀ ਰੈਨੋਵੇਟ ਕਰਵਾ ਰਹੇ ਹਾਂ ਵੀ ਕੁੜੀ ਵਾਲੇ ਵੀ ਆਉਣਗੇ ਵੇਖਣਗੇ ਸਾਰਾ ਕੁਛ ਅਤੇ ਫਿਰ ਚੰਗਾ ਜਿਹਾ ਨਹੀਂ ਲੱਗਦਾ ਸਾਰਾ ਰੈਨੋਵੇਟ ਕਰਵਾਉਣਾ ਹੁਣ ਅਸੀਂ ਦੁਬਾਰਾ ਬਣਾਉਣ ਲੱਗੇ ਹਾਂ

ਹਾਂਜੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਹਾਂਜੀ ਹਾਂਜੀ ਬਸ ਅਸੀਂ ਕੱਲ੍ਹ ਲਗਾ ਲੈਣੇ ਮਿਸਤਰੀ ਅਤੇ ਦੇਖੋ ਹੁਣ ਕਿੰਨੀ ਕੁ ਦੇਰ 'ਚ ਕੰਮ ਨਿਬੇੜਦੇ ਆ ਅਸੀਂ ਤਾਂ ਇਹ ਹੀ ਕੋਸ਼ਿਸ਼ ਕਰਾਂਗੇ ਵੀ ਛੇਤੀ ਨਾ ਛੇਤੀ ਕਰ ਦੇਣ ਕੰਮ ਨਿਬੇੜ ਦੇਣ ਅਤੇ ਬਾਕੀ ਫਿਰ ਵੀ ਥੋੜ੍ਹਾ ਬਹੁਤ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦਿਹਾੜੀਦਾਰ ਹੁੰਦੇ ਹੈ ਅਤੇ ਪੈਸੇ ਜ਼ਿਆਦਾ ਬਣਾਉਣ ਵਾਸਤੇ ਇੱਦਾਂ ਕਰ ਦਿੰਦੇ ਹੈ ਵੈਸੇ ਅਸੀਂ ਹਾਂ ਹਾਂਜੀ ਹਾਂਜੀ ਉਹ ਹੀ ਉਹ ਹੀ ਹੁਣ ਇੱਥੇ ਵੀ ਇਹਨਾਂ ਨੇ ਕਿਹਾ ਤਾਂ ਹੈਗਾ ਪੰਦਰਾਂ ਦਿਨਾਂ ਦਾ ਲੱਗਦਾ ਨਹੀਂ ਪਰ ਪੰਦਰਾਂ ਦਿਨਾਂ 'ਚ ਕਰ ਦੇਣਗੇ ਜਿਸ ਹਿਸਾਬ ਨਾਲ ਤਾਂ ਇਹ ਕਹਿੰਦੇ ਪਏ ਪਾ ਪਾ ਵੀ ਕਰ ਦਿੰਦੇ ਹਾਂ ਕਰ ਦਿੰਦੇ ਪਰਸੋਂ ਦਾ ਕਿਹਾ ਹੋਇਆ ਅਸੀਂ ਕਿ ਆ ਜਾਓ ਕਰ ਦਿਓ ਇੱਦਾਂ ਕਰਦੇ ਪਏ ਨੇ ਇੱਕ ਤਾਂ ਉਹ ਰੈਨੋਵੇਸ਼ਨ ਵੀ ਕਰਵਾਉਣੀ ਆ ਨਾ ਪੂਰੀ ਢਵਾ ਕੇ ਪਰੋ ਪੂਰਾ ਅਤੇ ਫਿਰ ਬਾਅਦ 'ਚ ਫਰਨੀਚਰ ਵਗੈਰਾ ਵੀ ਬੱਚੇ ਕਹਿੰਦੇ ਪਲਾਈ ਜੋ ਵੀ ਗੱਦਾ ਗੁੱਦਾ ਤੁਹਾਨੂੰ ਪਤਾ ਹੀ ਆ ਫਿਰ ਬੱਚਿਆਂ ਦਾ ਅੱਜ ਕੱਲ੍ਹ ਫਿਰ ਉਹ ਵੀ ਕਰਾ ਕਰਾਉਣਾ ਹੈ ਨਹੀਂ ਨਹੀਂ ਉਹਨੇ ਤਾਂ ਆਉਣਾ ਅਜੇ ਕੁੜੀ ਨੇ ਵੀ ਆਉਣਾ ਕੁੜੀ ਵੀ ਬਾਹਰ ਦੀ ਹੈ ਨਾ ਮਤਲਬ ਐਸੇ ਉਹਦੇ ਪੇਕੇ ਜਿਹੜੇ ਹੈਗੇ ਹੈ ਉਹ ਲੁਧਿਆਣੇ ਹੈ ਵੈਸੇ ਕੁੜੀ ਨਾਲ ਹੀ ਬਾਹਰ ਹੀ ਹੈ ਹਾਂ ਹਾਂ ਉਹ ਹੀ ਜਦੋਂ ਅਸੀਂ ਕਿਹਾ ਪਹਿਲਾਂ ਮਤਲਬ ਢਾਂਚਾ ਕਰਵਾ ਦੇਈਏ ਫਿਰ ਬਾਅਦ 'ਚ ਜਿਹੜੀ ਵੀ ਅੰਦਰ ਦਾ ਸਮਾਨ ਹੋਵੇਗਾ ਉਹ ਤਾਂ ਫਿਰ ਕਰਦੇ ਹੀ ਰਹਿਣਗੇ ਆਪੇ ਦੋਨੋ ਜਿਹੜੇ ਪਸੰਦ ਹੋਵੇਗਾ ਉਹਨਾਂ ਨੂੰ ਹਾਂਜੀ ਹਾਂਜੀ ਹਾਂਜੀ ਬਸ ਥੋੜ੍ਹਾ ਜਿਹਾ ਨਾ ਮਤਲਬ ਦੇਖ ਲਿਓ ਕਿਉਂਕਿ ਤੁਹਾਨੂੰ ਪਤਾ ਹੀ ਹੈ ਫਿਰ ਅੱਜ ਕੱਲ੍ਹ ਮਿਸਤਰੀ ਜਿਹੜੇ ਥੋੜ੍ਹੇ ਹੁੰਦੇ ਇੱਦਾਂ ਦੇ ਅਤੇ ਹਾਂ ਉਹ ਅਤੇ ਜਿਹੜੀ ਸਫਾਈ ਵਗੈਰਾ ਹੈਗੀ ਨਾ ਉਹ ਰੋਜ਼ ਕਰਕੇ ਜਾਣਗੇ ਵੀ ਪਾਣੀ ਵਗੈਰਾ ਕੋਈ ਹੋਵੇ ਨਾ ਖੁੱਲ੍ਹਾ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਆਵੇਗੀ ਪਰ ਫਿਰ ਵੀ ਹਾਂਜੀ ਚਲੋ ਠੀਕ ਹੈ ਜੀ ਇਹ ਆ ਗਏ ਮੈਂ ਰੋਟੀ ਪਾਣੀ ਦਾ ਵੀ ਦੇਖਣਾ ਥੋੜ੍ਹਾ ਬਹੁਤ ਹਾਂਜੀ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ